ਉਂਝ ਤਾਂ ਦੇਖਣ ਲਈ ਮਨਪਸੰਦ ਬਹੁਤ ਥਾਵਾਂ ਹਨ ਪਰ ਮੈਨੂੰ ਜਿਨ੍ਹਾਂ ਵਿੱਚੋਂ ਡਲਹੌਜ਼ੀ ਗੋਆ ਨੈਨੀਤਾਲ ਸ਼ਿਮਲਾ ਅਤੇ ਅੰਮ੍ਰਿਤਸਰ ਪਸੰਦ ਹੈ ਪ ਪਹਾੜੀ ਇਲਾਕਿਆਂ ਵਿੱਚ ਮੌਸਮ ਬਹੁਤ ਵਧੀਆ ਰਹਿੰਦਾ ਹੈ ਉੱਥੋਂ ਦੀ ਜਨਸੰਖਿਆ ਬਹੁਤ ਘੱਟ ਹੈ ਉੱਥੇ ਸਾਫ ਸੁਥਰਾ ਵਾਤਾਵਰਨ ਹੈ ਅਤੇ ਉੱਥੇ ਨਦੀਆਂ ਝਰਨੇ ਬਹੁਤ ਹਨ ਜੋ ਕਿ ਵਧੀਆ ਦ ਦ੍ਰਿਸ਼ ਦਰਸਾਉਂਦੇ ਹਨ ਸ਼੍ਰੀ ਅੰਮ੍ਰਿਤਸਰ ਸਾਹਿਬ ਇਸ ਕਰਕੇ ਮੈਨੂੰ ਪਸੰਦ ਹੈ ਕਿਉਂਕਿ ਉਹ ਸਾਡੇ ਸਿੱਖ ਧਰਮ ਦੇ ਨਾਲ਼ ਜੁੜਿਆ ਹੋਇਆ ਇਤਿਹਾਸਿਕ ਅਸਥਾਨ ਹੈ